ਮੈਨੂੰ ਬਚਪਨ ਤੋਂ ਹੀ ਡਾਂਸ ਦਾ ਬਹੁਤ ਸ਼ੌਕ ਸੀ ਅਤੇ ਇਹ ਸ਼ੌਕ ਅੱਜ ਵੀ ਉੱਨਾ ਹੀ ਜਿੰਨਾ ਉਦੋਂ ਸੀ ਮੈਂ ਬਚਪਨ ਵਿੱਚ ਡਾਂਸ ਸ਼ੋਜ ਵੇਖਿਆ ਕਰਦੀ ਸੀ ਅਤੇ ਇਸ ਨਾਲ ਮੇਰੀ ਬਹੁਤ ਹੀ ਅੱਛਾ ਸੀ ਕਿ ਮੈਂ ਡਾਂਸ ਅੱਗੇ ਵੀ ਸਿੱਖਾਂ ਮੈਨੂੰ ਪੰਜਾਬੀ ਲੋਕ ਨਾਚ ਜਿਵੇਂ ਭੰਗੜਾ ਗਿੱਧਾ ਇਹਨਾਂ ਵਿੱਚ ਬਹੁਤ ਹੀ ਜ਼ਿਆਦਾ ਦਿਲਚਸਪੀ ਸੀ ਜਦੋਂ ਮੈਂ ਛੋਟੇ ਹੁੰਦੇ ਸੀ ਉਹ ਸਾਡੇ ਸਕੂਲ ਵਿੱਚ ਇੰਨਾਂ ਕੁ ਡਾਂਸ ਨੂੰ ਮਹੱਤਵ ਨਹੀਂ ਸੀ ਦਿੱਤਾ ਜਾਂਦਾ ਪਰ ਜਦੋਂ ਮੈਂ ਵੱਡੀ ਕਲਾਸਾਂ 'ਚ ਆਈ ਤਾਂ ਇੱਕ ਵਾਰੀ ਸਾਡੇ ਸਕੂਲ ਵਿੱਚ ਡਾਂਸ ਪ੍ਰਤੀਯੋਗਿਤਾ ਹੋਈ ਜਿਸ ਵਿੱਚ ਮੈਂ ਭਾਗ ਲਿੱਤਾ ਪਰ ਮੈਨੂੰ ਇੰਨਾਂ ਅੱਛਾ ਡਾਂਸ ਨਹੀਂ ਸੀ ਕਰਨਾ ਆਉਂਦਾ ਪਰ ਮੇਰੇ ਮਾਤਾ ਪਿਤਾ ਨੇ ਅਤੇ ਮੇਰੇ ਅਧਿਆਪਕਾਂ ਨੇ ਮੈਨੂੰ ਬਹੁਤ ਉਤਸ਼ਾਹਿਤ ਕੀਤਾ ਇਸੇ ਉਤਸਾਹ ਨਾਲ ਮੈਂ ਪਹਿਲਾ ਦਰਜਾ ਪ੍ਰਾਪਤ ਕੀਤਾ ਇਸ ਪ੍ਰਤਿਯੋਗਿਤਾ ਨੂੰ ਜਿੱਤਣ ਤੋਂ ਬਾਅਦ ਮੈਂ ਆਪਦੇ ਘਰ ਵਾਲਿਆਂ ਨੂੰ ਅੱਗੇ ਡਾਂਸ ਸਿੱਖਣ ਦੀ ਆਪਣੀ ਇੱਛਾ ਦੱਸੀ ਉਹਨਾਂ ਨੇ ਮੇਰਾ ਦਾਖਲਾ ਇੱਕ ਡਾਂਸ ਅਕੈਡਮੀ ਵਿੱਚ ਕਰਵਾ ਦਿੱਤਾ ਜਿੱਥੇ ਮੈਂ ਕੱਥਕ ਅਤੇ ਭੰਗੜਾ ਸਿੱਖ ਰਹੀ ਹਾਂ ਮੈਂ ਆਪਦੀ ਪੜ੍ਹਾਈ ਦੇ ਨਾਲ ਨਾਲ ਹੀ ਡਾਂਸ ਵੀ ਸਿੱਖ ਰਹੀ ਹਾਂ ਮੇਰਾ ਸੁਫਨਾ ਇਹ ਹੈ ਕਿ ਮੈਂ ਡੀ ਆਈ ਡੀ ਵਿੱਚ ਜਾਵਾਂ ਅਤੇ ਉਸ ਮੁਕਾਮ ਨੂੰ ਹਾਸਿਲ ਕਰਾਂ ਉਸ ਮੁਕਾਮ ਨੂੰ ਜਿੱਤਾਂ ਮੇਰਾ ਗੋਲ ਇਹ ਹੈ ਕਿ ਮੈਂ ਆਪਣੇ ਇਸ ਸ਼ੌਂਕ ਨੂੰ ਆਪਣੇ ਇੱਕ ਡਾਂਸ ਪ੍ਰਤੀ ਪਿਆਰ ਨੂੰ ਐਵੇਂ ਵੀ ਅੱਗੇ ਕਾਇਮ ਰੱਖਣਾ ਚਾਹੁੰਦੀ ਹਾਂ ਅਤੇ ਇਸੇ ਨੂੰ ਹੀ ਮੈਂ ਆਪਣਾ ਰੁਜ਼ਗਾਰ ਬਣਾਉਣਾ ਚਾਹੁੰਦੀ ਹਾਂ ਕਿਉਂਕਿ ਮੇਰਾ ਮੰਨਣਾ ਇਹ ਹੈ ਕਿ ਡਾਂਸ ਕਰਨ ਨਾਲ ਸਾਡਾ ਇੱਕ ਤਾਂ ਸਰੀਰ ਸਵੱਸਥ ਰਹਿੰਦਾ ਹੈ ਅਤੇ ਜਦੋਂ ਵੀ ਮੈਨੂੰ ਕੋਈ ਪਰੇਸ਼ਾਨੀ ਹੁੰਦੀ ਹੈ ਕੋਈ ਟੈਂਸ਼ਨ ਹੁੰਦੀ ਹੈ ਮੈਂ ਡਾਂਸ ਕਰਦੀ ਹਾਂ ਕਿਉਂਕਿ ਇਸ ਨਾਲ ਮੈਨੂੰ ਇੱਕ ਅਲੱਗ ਹੀ ਖੁਸ਼ੀ ਪ੍ਰਾਪਤ ਹੁੰਦੀ ਹੈ ਇਸ ਲਈ ਮੈਂ ਆਪਦੇ ਇਸ ਸ਼ੌਂਕ ਨੂੰ ਹੀ ਆਪਣਾ ਰੁਜ਼ਗਾਰ ਬਣਾਉਣਾ ਚਾਹੁੰਦੀ ਹਾਂ ਅਤੇ ਅੱਗੇ ਜਾ ਕੇ ਆਪਣੀ ਹੀ ਇੱਕ ਡਾਂਸ ਅਕੈਡਮੀ ਖੋਲ੍ਹਣਾ ਚਾਹੁੰਦੀ ਹਾਂ ਜਿਸ ਨਾਲ ਮੈਂ ਹੋਰ ਲੋਕਾਂ ਨੂੰ ਡਾਂਸ ਸਿਖਾ ਸਕਾਂ ਜੋ ਕਿ ਇੰਨੇ ਕਾਬਿਲ ਨਹੀਂ ਹਨ ਕਿ ਉਹ ਕਿਸੇ ਹੋਰ ਅਕੈਡਮੀ 'ਚ ਜਾ ਕੇ ਵੱਡੇ ਵੱਡੀਆਂ ਅਕੈਡਮੀਆਂ 'ਚ ਜਾ ਕੇ ਜ਼ਿਆਦਾ ਪੈਸੇ ਦੇ ਕੇ ਡਾਂਸ ਸਿੱਖੇ ਉਹਨਾਂ ਨੂੰ ਮੈਂ ਆਪਣੀ ਡਾਂਸ ਅਕੈਡਮੀ 'ਚ ਡਾਂਸ ਸਿਖਾ ਸਕਾਂ